ਮੈਨੇ ਥੋੜ੍ਹੇ ਦਿਨ ਪਹਿਲਾਂ ਫਲਿੱਪਕਾਰਟ ਤੋਂ ਆਪਣੇ ਏਅਰਪੋਰਡਸ ਦਾ ਔਡਰ ਕੀਤਾ ਸੀ ਅਤੇ ਮੈਨੂੰ ਇਹ ਔਡਰ ਅੱਜ ਰਸੀਵ ਹੋ ਗਿਆ ਜਦੋਂ ਮੈਨੇ ਇਹ ਔਡਰ ਦੀ ਪੈਕਿੰਗ ਦੇਖੀ ਤਾਂ ਪੈਕਿੰਗ ਕੁਝ ਮੈਨੂੰ ਖ਼ਾਸ ਨਹੀਂ ਲੱਗੀ ਪਰ ਮੈਨੇ ਫਿਰ ਪੈਕਿੰਗ ਜਦੋਂ ਖੋਲ੍ਹੀ ਤਾਂ ਉਸ ਵਿੱਚ ਮੈਨੇ ਦੇਖਿਆ ਕਿ ਮੈਂ ਤਾਂ ਆਈ ਫੋਨ ਦੇ ਮੰਗਵਾਏ ਸੀ ਏਅਰਪੋਰਡਸ ਪਰ ਮੈਨੂੰ ਦੇਸੀ ਕੰਪਨੀ ਦੇ ਆਈ ਪੋਰਡਸ ਰਸੀਵ ਹੋਏ ਨੇ ਪਰ ਜਦੋਂ ਮੈਨੇ ਇਸ ਨੂੰ ਕਨੈਕਟ ਵੀ ਕੀਤਾ ਬਲਿਊਟੁੱਥ ਨਾਲ ਤਾਂ ਇਸ ਦੀ ਅਵਾਜ਼ ਵੀ ਫੱਟ ਫੱਟ ਕੇ ਆ ਰਹੀ ਸੀ ਅਤੇ ਚੰਗੇ ਨਹੀਂ ਚੱਲ ਰਹੇ ਸੀਗੇ ਮੈਨੂੰ ਮੇਰੇ ਘਰ ਤੋਂ ਵੀ ਬਹੁਤ ਸੁਣਨਾ ਪਿਆ ਕਿਉਂਕਿ ਇਹ ਏਅਰਪੋਰਡਸ ਬਜ਼ਾਰ ਵਿੱਚ ਤਾਂ ਪੰਜ ਸੌ ਦੇ ਸੀ ਪਰ ਮੈਨੂੰ ਔਨਲਾਈਨ ਸੱਤ ਹਜ਼ਾਰ ਦੇ ਪੈ ਗਏ ਤਾਂ ਕਰਕੇ ਮੈਂ ਤੁਹਾਨੂੰ ਕਹਿਣਾ ਚਾਹੁੰਦੀ ਹਾਂ ਕਿ ਜਾਂ ਤਾਂ ਮੇਰੇ ਔਡਰ ਰਿਪਲੇਸ ਕੀਤਾ ਜਾਵੇ ਜਾਂ ਮੇਰੇ ਪੈਸੇ ਰਿਫੰਡ ਕੀਤੇ ਜਾਣ ਧੰਨਵਾਦ